ਹੈਲੋ ਗੁੱਡ ਇਵਨਿੰ ਗੁੱਡ ਆਫਟਰ ਨੂਨ ਮੈਮ ਮੈਮ ਆਪ ਪਾਇਲ ਮੈਮ ਬਾਤ ਕਰ ਰਹੇ ਹੈਂ ਮੈਮ ਮੇਰੇ ਕੋ ਨਾ ਕਿਸੇ ਨੇ ਮੈਂ ਡਾਕਟਰ ਕੇ ਪਾਸ ਗਈ ਸੀ ਆਪਣਾ ਰੁਟੀਨ ਚੈਕਅੱਪ ਕਰਵਾਨੇ ਕੇ ਲੀਏ ਤੋਂ ਉਨੋਂ ਨੇ ਮੇਰਾ ਥੋੜ੍ਹਾ ਡਾਊਟ ਮਤਲਬ ਮੇਰੇ ਕੋ ਹੁਆ ਉਨੋਂ ਨੇ ਬਤਾਇਆ ਕਿ ਆਪਕੋ ਥੋੜ੍ਹੀ ਸ਼ੂਗਰ ਕੀ ਪ੍ਰੋਬਲਮ ਆ ਰਹੀ ਹੈ ਹਾਂਜੀ ਤੋਂ ਮੈਮ ਉਸ ਕੇ ਰਿਗਾਰਡਿੰਗ ਮੇਰੇ ਕੋ ਆਪਸੇ ਮੇਰੇ ਕੋ ਕਿਸੀ ਨੇ ਆਪ ਕਾ ਨੰਬਰ ਦੀਆ ਥਾ ਕਹਤੇ ਕੇ ਉਨਸੇ ਬਾਤ ਕਰਲੋ ਹਾਂਜੀ ਆਪ ਮੇਰੇ ਕੋ ਹਾਂਜੀ ਮੈਮ ਉਨੋਂ ਨੇ ਮੈਡੀਸਨ ਦੀ ਹੈ ਜੋ ਰੁਟੀਨ ਮੇ ਲੇਨੀ ਹੈ ਮੈਮ ਇੱਕ ਵਾਰੀ ਪੰਜ ਦਿਨਾਂ ਦੀ ਦਿੱਤੀ ਹੈ ਕਹਿੰਦੇ ਵੀ ਤੁਸੀਂ ਆਹ ਖਾ ਕੇ ਦੇਖੋ ਵੀ ਤੁਹਾਨੂੰ ਠੀਕ ਲੱਗਦਾ ਹੈ ਤਾਂ ਮਤਲਬ ਆਈ ਚੱਲਣ ਦੇਵਾਂਗੇ ਅਤੇ ਅਗਰ ਹੋਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਮਤਲਬ ਨੈਕਸਟ ਟ੍ਰੀਟਮੈਂਟ ਸਟਾਰਟ ਕਰਾਂਗੇ ਤਾਂ ਮੈਂ ਥੋੜ੍ਹਾ ਸਜੈਸ਼ਨ ਲੈ ਰਹੀ ਸੀ ਤੁਹਾਡਾ ਵੀ ਕੀ ਕੀ ਕਰਨਾ ਇਹਦੇ ਵਿੱਚ ਸ਼ੁੱਗਰ ਵਿੱਚ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਕਿਸ ਤਰ੍ਹਾਂ ਦਾ ਖਾਣਾ ਫੂਡ ਖਾਣਾ ਹੈ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਮ ਹਾਂਜੀ ਮੈਮ ਹਾਂਜੀ ਮੈਮ ਉਹੀ ਤਾਂ ਮੈਂ ਤੁਹਾਨੂੰ ਸਜੈਸ਼ਨ ਲੈ ਰਹੀ ਸੀ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਵੀ ਰੂਟੀਨ 'ਚ ਆਪਣਾ ਖਾਣਾ ਵਗੈਰਾ ਰੱਖਣਾ ਅਤੇ ਮੈਮ ਵੈਸੇ ਬੌਡੀ ਪੇਨ ਜਿਹੀ ਹੁੰਦੀ ਹੈ ਤਾਂ ਕਿ ਹਾਂਜੀ ਮੈਮ ਹਾਂਜੀ ਮੈਮ ਹੰਜੀ ਓਕੇ ਮੈਮ ਤੁਸੀਂ ਹਾਂਜੀ ਮੈਮ ਤੁਸੀਂ ਪ੍ਰੋਪਰਲੀ ਸਟਡੀਓਅਲ ਮੈਨੂੰ ਮੈਸੇਜ ਕਰ ਦਿਓ ਅਤੇ ਮੈਂ ਫੋਲੋ ਕਰ ਲਵਾਂਗੀ ਅਤੇ ਮੈਂ ਤੁਹਾਨੂੰ ਜ਼ਰੂਰ ਕਾਲ ਕਰਕੇ ਦੱਸਾਂਗੀ ਵੀ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਹਾਂਜੀ ਹਾਂਜੀ ਮੈਮ ਓਕੇ ਮੈਮ ਤੁਹਾਨੂੰ ਜ਼ਰੂਰ ਕਾਲ ਕਰਾਂਗੀ ਅਤੇ ਪਲੀਜ਼ ਸੈਂਡ ਕਰ ਦਿਓ ਅਤੇ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਮੈਂ ਤੁਹਾਨੂੰ ਕਾਲ ਕਰਾਂਗੀ ਓਕੇ ਮੈਮ ਥੈਂਕ ਯੂ ਸੋ ਮਚ ਬਾਏ ਮੈਮ